ਹਾਂਜੀ ਮੈਂ ਨਾ ਤੁਹਾਡੇ ਨਾਲ ਆਪਣਾ ਇੱਕ ਅਨੁਭਵ ਸਾਂਝਾ ਕਰਨਾ ਚਾਹੁੰਦਾ ਹੈਗਾ ਜੋ ਯੋਗਾ ਦੇ ਦੌਰਾਨ ਜਿਹੜਾ ਮੈਨੂੰ ਉਹਦਾ ਫਾਇਦਾ ਹੋਇਆ ਮੈਨੂੰ ਸਰੀਰਕ ਅਤੇ ਮਾਨਸਿਕ ਜਿਹੜੀਆਂ ਸਿਹਤ ਸਮੱਸਿਆਵਾਂ ਮੇਰੀਆਂ ਦੂਰ ਹੋਈਆਂ ਯੋਗਾ ਕਰਨ ਦੇ ਨਾਲ ਉਹ ਮੈਂ ਤੁਹਾਡੇ ਨਾਲ ਕੁਝ ਸਾਂਝੀਆਂ ਕਰਨਾ ਚਾਹੁੰਦਾ ਕਿਉਂਕਿ ਯੋਗਾ ਕਰਨਾ ਨਾ ਬਹੁਤ ਵਧੀਆ ਚੀਜ਼ ਹੈਗੀ ਇੱਕ ਅਜਿਹਾ ਅਭਿਆਸ ਹੈਗਾ ਜਿਹੜਾ ਸਾਡੇ ਸਰੀਰ ਅਤੇ ਮਨ ਦੇ ਨਾਲ ਨਾ ਜੋੜ ਦਿੰਦਾ ਦੋਨਾਂ ਦਾ ਮਿਲਾਪ ਕਰ ਦਿੰਦਾ ਹੈਗਾ ਸਰੀਰ ਦਾ ਅਤੇ ਮਨ ਦਾ ਅਤੇ ਇਹੀ ਗੱਲ ਹੈ ਵੀ ਮਨੁੱਖ ਨੂੰ ਇਹ ਨਾ ਜਿਹੜਾ ਯੋਗਾ ਜ਼ਰੂਰ ਕਰਨਾ ਚਾਹੀਦਾ ਹੈਗਾ ਅਤੇ ਜਿਹੜਾ ਕਿ ਯੋਗਾ ਹੈਗਾ ਸਾਡਾ ਤਣਾਅ ਨੂੰ ਚਿੰਤਾ ਨੂੰ ਉਦਾਸੀ ਨੂੰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈਗਾ ਅਤੇ ਇਸ ਤੋਂ ਇਲਾਵਾ ਆਪਾਂ ਐਂ ਵੀ ਜੇ ਗੱਲ ਕਰੀਏ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਕਰਦਾ ਹੈਗਾ ਲਚਕਤਾ ਨੂੰ ਵਧਾਉਂਦਾ ਹੈਗਾ ਅਤੇ ਅਤੇ ਆਪਣੇ ਸੰਤੁਲਨ ਨੂੰ ਬਿਹਤਰ ਬਣਾ ਸਕਦੇ ਹਾਂ ਆਪਾਂ ਜਦੋਂ ਆਪਾਂ ਯੋਗਾ ਕਰਦੇ ਹਾਂ ਅਤੇ ਆਪਣੀ ਜਿਹੜੀ ਪਾਚਨ ਸ਼ਕਤੀ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਜੇ ਆਪਾਂ ਲਗਾਤਾਰ ਯੋਗਾ ਕਰਦੇ ਰਹਿੰਦੇ ਹਾਂ ਜੇਕਰ ਆਪਾਂ ਨੂੰ ਕਿਸੇ ਖਾਸ ਸਰੀਰਕ ਜਾਂ ਮਾਨਸਿਕ ਸਿਹਤ ਜਾਂ ਸਮੱਸਿਆ ਦਾ ਸਾਹਮਣਾ ਕਰਦੇ ਹਾਂ ਤਾਂ ਆਪਾਂ ਨੂੰ ਇੱਕ ਨਾ ਯੋਗਾ ਅਧਿਆਪਕ ਹੁੰਦੇ ਨੇ ਜੋ ਯੋਗ ਕਰਵਾਉਂਦੇ ਸਾਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਸਲਾਹ ਲੈਣੀ ਚਾਹੀਦੀ ਹੈ ਉਹ ਲੋੜ ਦੇ ਅਨੁਸਾਰ ਆਪਾਂ ਨੂੰ ਯੋਗਾ ਕਰਨਾ ਚਾਹੀਦਾ ਐਂਏ ਨਹੀਂ ਆਪਾਂ ਬਈ ਰੀਸਮ ਰੀਸ ਕਿਸੇ ਤੂੰ ਵੀ ਆਹ ਆਹ ਕਰਦਾ ਆਹ ਆਹ ਕਰਦਾ ਮੈਂ ਵੀ ਇਹ ਕਰਨੀ ਆਪਾਂ ਨੂੰ ਇੱਕ ਐਕਸਪਰਟ ਦੀ ਸਲਾਹ ਦੇ ਵਿੱਚ ਉਹਦੀ ਨਿਗਰਾਨੀ ਦੇ ਵਿੱਚ ਹੀ ਆਪਾਂ ਨੂੰ ਕਰਨਾ ਚਾਹੀਦਾ ਵੀ ਮੈਨੂੰ ਪੇਟ ਦੀ ਸਮੱਸਿਆ ਤਾਂ ਮੈਂ ਮੈਂ ਕਿਹੜਾ ਯੋਗਾ ਕਰਾਂ ਜੇ ਮੈਨੂੰ ਕਿਸੇ ਹੋਰ ਅੰਗ ਪੈਰ ਦੀ ਸਮੱਸਿਆ ਤਾਂ ਮੈਂ ਕਿਹੜਾ ਯੋਗਾ ਕਰਾਂ ਮਾਨਸਿਕ ਇੱਕ ਸਮੱਸਿਆ ਤੋਂ ਮੈਂ ਉਹ ਕਿਹੜਾ ਯੋਗਾ ਕਰਾਂ ਇਹ ਆਪਾਂ ਨੂੰ ਇੱਕ ਐਕਸਪਰਟ ਜਿਹੜੇ ਯੋਗਾ ਗੁਰੂ ਨੇ ਯੋਗਾ ਟੀਚਰ ਨੇ ਉਹੀ ਦੱਸ ਸਕਦੇ ਆ ਸਾਨੂੰ ਆਪਣੇ ਆਪ ਪੰਗਾ ਨਹੀਂ ਲੈਣਾ ਚਾਹੀਦਾ ਇਹਨਾਂ ਦੇ ਨਾਲ ਤਾਂ ਬਹੁਤ ਸਾਰੇ ਜਿਹੜੇ ਯੋਗਾ ਆਸਣ ਨੇ ਜਿਹੜੇ ਆਪਣੇ ਲਈ ਫਾਇਦੇਮੰਦ ਹੁੰਦੇ ਹਨ ਮੈਂ ਵੀ ਬਹੁਤ ਜ਼ਿਆਦਾ ਯੋਗਾ ਜਿਹੜਾ ਕਰਦਾ ਹੈਗਾ ਉਹਨਾਂ ਵਿੱਚੋਂ ਮੈਂ ਤੁਹਾਡੇ ਨਾਲ ਥੋੜ੍ਹੇ ਜਿਹੇ ਆਪਣਾ ਡਿਸਕਸ ਕਰਦਾ ਹੈਗਾ ਇੱਕ ਹੁੰਦਾ ਤਿਕੌਣ ਆਸਣ ਇਹ ਨਾ ਤਿਕੌਣ ਦਾ ਪੋਜ ਬਣਾਉਂਦਾ ਹੈਗਾ ਆਪਣਾ ਇਹ ਇਹ ਆਸਣ ਜਿਹੜਾ ਆਪਣੇ ਸਰੀਰ ਨੂੰ ਲਚੀਲਾ ਬਣਾਉਣ ਦੇ ਵਿੱਚ ਪਾਚਨ ਨੂੰ ਬਿਹਤਰ ਬਣਾਉਣ ਦੇ ਵਿੱਚ ਅਤੇ ਤਣਾਅ ਨੂੰ ਬਹੁਤ ਘੱਟ ਕਰ ਦਿੰਦਾ ਬਹੁਤ ਵਧੀਆ ਆਸਣ ਹੈਗਾ ਇੱਕ ਹੁੰਦਾ ਆਪਣਾ ਵਿਰਪ੍ਰਾਦਰਸ਼ਨ ਆਸਣ ਇਹਨੂੰ ਵਾਰੀਅਰ ਪੋਜ਼ ਵੀ ਕਹਿ ਦਿੰਦੇ ਆਪਾਂ ਇਹਨੂੰ ਇਹ ਆਸਣ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈਗਾ ਇਹ ਸੰਤੁਲਨ ਨੂੰ ਬਿਹਤਰ ਬਣਉਂਦਾ ਊਰਜਾ ਦੇ ਪੱਧਰ ਨੂੰ ਵਧਾਉਣ ਦੇ ਵਿੱਚ ਵੀ ਆਪਣਾ ਮਦਦ ਕਰਦਾ ਹੈਗਾ ਇੱਕ ਹੈਗਾ ਇਹੀ ਆਪਣਾ ਸਾਵ ਆਸਣ ਸਾਵ ਆਸਣ ਕੀ ਹੈ ਇਹ ਜਿਹੜਾ ਆ ਆਸਣ ਹੈਗਾ ਆਪਣੇ ਸਰੀਰ ਅਤੇ ਮਨ ਨੂੰ ਆਰਾਮ ਦਿੰਦਾ ਹੈ ਤਣਾਅ ਨੂੰ ਘਟਾਉਣ ਦੇ ਵਿੱਚ ਆਪਣੀ ਮਦਦ ਕਰਦਾ ਹੈਗਾ ਠੀਕ ਹੈ ਜੀ ਇਹ ਸਾਰੇ ਜਿਹੜੇ ਆਸਣ ਹੈਗੇ ਇਹ ਤਾਂ ਹੀ ਫਾਇਦੇਮੰਦ ਹੈਗੇ ਜੇ ਆਪਾਂ ਇਹਨਾਂ ਨੂੰ ਲਗਾਤਾਰ ਜਿਹੜਾ ਕਿ ਇਹ ਕਰਦੇ ਰਹੀਏ ਇਹਨਾਂ ਨੂੰ ਠੀਕ ਹੈ ਅਤੇ ਕਰੀਏ ਵੀ ਕਿਸੇ ਡੋਕਟਰ ਜਾਂ ਕਿਸੇ ਯੋਗਾ ਟੀਚਰ ਦੀ ਸਲਾਹ ਦੇ ਨਾਲ ਕਰੀਏ ਇਵੇਂ ਮੈਂ ਆਪਾਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਸਕਿਆ ਹੈਗਾ ਬਈ ਇੱਦਾਂ ਨਹੀਂ ਕਰਨੇ ਚਾਹੀਦੇ ਤਾਂ ਜਿਹੜੀ ਇਹ ਆਸਣ ਮੈਂ ਤਿੰਨ ਤੁਹਾਡੇ ਨਾਲ ਆਪਦੇ ਵਿਚਾਰ ਸਾਂਝੇ ਕੀਤੇ ਆ ਇਹ ਬਹੁਤ ਜ਼ਿਆਦਾ ਵਧੀਆ ਸੀ ਭਾਈ ਤੁਹਾਨੂੰ ਸਾਰਿਆਂ ਨੂੰ ਹੀ ਵਰਤਣੇ ਚਾਹੀਦੇ ਆ ਜਿਵੇਂ ਮੇਰੀ ਐਡੀ ਉਮਰ ਆ ਮੈਂ ਜ਼ਰੂਰ ਕਰਦਾ ਹੈਗਾ ਵੀ ਜ਼ਿਆਦਾ ਹਾਰਡ ਹੈ ਉਹ ਨਹੀਂ ਮੈਂ ਕਰਦਾ ਹੈਗਾ ਕਿੰਨੀ ਕੁ ਸੌਖੇ ਸੌਖੇ ਤਾਂ ਕਰ ਲਈਦੇ ਆ ਬਸ ਸਰੀਰ ਦਾ ਬਹੁਤ ਵਧੀਆ ਬਣਿਆ ਰਹਿੰਦਾ ਤਾਂ ਸਾਰਿਆਂ ਨੂੰ ਇਹੀ ਸਲਾਹ ਹੈਗੀ ਭਾਈ ਸਾਰਿਆਂ ਨੂੰ ਕਰਨਾ ਚਾਹੀਦਾ ਹੈਗਾ ਯੋਗਾ ਬਹੁਤ ਜ਼ਰੂਰੀ ਹੈ ਆਪਣੇ ਸਰੀਰ ਦੇ ਲਈ